ਅਸੀਂ ਖਾਣਾ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਅਸੀਂ ਖਾਣਾ ਤਿਆਰ ਕਰਨਾ ਹੁੰਦਾ ਹੈ ਚਪਾਤੀ ਬਣਾਉਣ ਤੋਂ ਪਹਿਲਾਂ ਅਸੀਂ ਆਟਾ ਗੁੰਨ ਕੇ ਰੱਖ ਲੈਂਦੇ ਹਾਂ ਤਾਂ ਕਿ ਆਟੇ ਨੂੰ ਅੱਧਾ ਘੰਟਾ ਰੈਸਟ ਮਿਲ ਰੈਸਟ ਮਿਲ ਜਾਂਦੀ ਹੈ ਅਤੇ ਫੁਲਕੇ ਬੜੇ ਹੀ ਸੋਹਣੇ ਅਤੇ ਸੋਫਟ ਬਣਦੇ ਨੇ ਸਬਜ਼ੀ ਬਣਾਉਣ ਤੋਂ ਪਹਿਲਾਂ ਅਸੀਂ ਸਬਜ਼ੀ ਸਾਰੀ ਕੱਟ ਲੈਂਦੇ ਹਾਂ ਸਬਜ਼ੀ ਨੂੰ ਕੱਟ ਕੇ ਸਾਰੇ ਮਸਾਲੇ ਕੱਟ ਲੈਂਦੇ ਹਾਂ ਲਸਣ ਪਿਆਜ ਅਦਰਕ ਹਰੀ ਮਿਰਚ ਟਮਾਟਰ ਸਾਰੇ ਮਸਾਲੇ ਕੱਟ ਕੇ ਉਹਨਾਂ ਨੂੰ ਬੀਟ ਕਰਕੇ ਰੱਖ ਲੈਂਦੇ ਹਾਂ ਸਬਜ਼ੀ ਨੂੰ ਅੱਛੀ ਤਰ੍ਹਾਂ ਧੋ ਲਿਆ ਜਾਂਦਾ ਹੈ ਸਬਜ਼ੀ ਨੂੰ ਧੋ ਕੇ ਮਸਾਲੇ ਨੂੰ ਬੀਟ ਕਰਕੇ ਤੜਕਾ ਲਾਇਆ ਜਾਂਦਾ ਹੈ ਮਸਾਲੇ ਅਸੀਂ ਘੱਟ ਹੀ ਪਾਨੇ ਹਾਂ ਜ਼ਿਆਦਾ ਨਹੀਂ ਪਾਉਂਦੇ ਨਮਕ ਮਿਰਚ ਮਸਾਲਾ ਘੱਟ ਹੀ ਪਾਇਆ ਜਾਂਦਾ ਹੈ ਸਵਾਦ ਅਨੁਸਾਰ ਹੀ ਪਾਇਆ ਜਾਂਦਾ ਨਮਕ ਵੀ ਅਸੀਂ ਆਇਓਡੀਨ ਵਾਲਾ ਨਮਕ ਯੂਜ਼ ਕਰਦੇ ਹਾਂ ਜੋ ਕਿ ਬੀਪੀ ਤੋਂ ਸਾਨੂੰ ਰਾਹਤ ਮਿਲਦੀ ਹੈ ਬੀਪੀ ਨਹੀਂ ਵਧਦਾ ਜਿਹਦੇ ਨਾਲ ਸਾਡਾ ਸੈਦਾ ਨਮਕ ਯੂਜ ਕਰਦੇ ਹਾਂ ਸਬਜ਼ੀਆਂ ਨੂੰ ਕੱਟ ਕੇ ਧੋ ਕੇ ਅੱਛੀ ਤਰ੍ਹਾਂ ਨਾਲ ਤੜਕਾ ਲਗਾ ਕੇ ਲਗਾ ਦਿੱਤਾ ਜਾਂਦਾ ਹੈ ਆਟਾ ਗੁੰਨਿਆ ਪਿਆ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਆਪਣੇ ਇੱਕ ਸਾਈਡ 'ਤੇ ਸਬਜ਼ੀ ਧਰ ਕੇ ਦੂਸਰੀ ਸਾਈਡ 'ਤੇ ਅਸੀਂ ਫੁਲਕੇ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਕਿ ਜਦੋਂ ਵੀ ਖਾਣਾ ਖਾਣਾ ਏ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਵੀ ਖਾਣਾ ਅਜੇ ਰੈਡੀ ਨੀ ਹੋਇਆ ਉਸ ਨੂੰ ਸ ਇੱਕ ਸਾਈਡ 'ਤੇ ਸਬਜੀ ਰੈਡੀ ਹੋ ਚੁੱਕੀ ਹੁੰਦੀ ਦੂਸਰੀ ਸਾਈਡ 'ਤੇ ਫੁਲਕੇ ਰੈਡੀ ਹੋ ਚੁੱਕੇ ਹੁੰਦੇ ਅਤੇ ਸਾਰੇ ਰਲ ਮਿਲ ਕੇ ਬੈਠ ਕੇ ਖਾਣਾ ਖਾਂਦੇ ਆ